ਆਪਣੇ ਘਰ ਵਿੱਚ ਖਾਣਾ ਮੈਂ ਆਪ ਹੀ ਬਣਾਉਂਦੀ ਹਾਂ ਅਤੇ ਖਾਣੇ ਜਾਂ ਪਕਵਾਨ ਬਣਾਉਣ ਵੇਲੇ ਕਈ ਸਾਰੇ ਮਸਾਲੇ ਲੱਗਦੇ ਹਨ ਕਈ ਮਸਾਲੇ ਸਾਡੇ ਆਪਣੇ ਘਰ ਵਿੱਚ ਹੁੰਦੇ ਕਈ ਅਸੀਂ ਬਾਹਰੋਂ ਮੰਗਵਾਉਂਦੇ ਹਾਂ ਅਤੇ ਕੁਝ ਮਸਾਲੇ ਅਸੀਂ ਘਰ ਖੁਦ ਪੀਸ ਕੇ ਬਣਾਉਨੇ ਹਾਂ ਜੋ ਪਕਵਾਨ ਦਾ ਸਵਾਦ ਨੂੰ ਵਧਾ ਦਿੰਦੇ ਹਨ ਅਤੇ ਖਾਣਾ ਬਣਾਉਣਾ ਮੈਨੂੰ ਬਹੁਤ ਹੀ ਪਸੰਦ ਹੈ ਮੇਰੇ ਘਰਦਿਆਂ ਨੂੰ ਵੀ ਖਾਣਾ ਮੇਰੇ ਹੱਥ ਦਾ ਬਹੁਤ ਹੀ ਅੱਛਾ ਲੱਗਦਾ ਹੈ ਕਿਉਂਕਿ ਇਸਨੂੰ ਮੈਂ ਬੜੇ ਹੀ ਠੰਡੇ ਦਿਮਾਗ ਨਾਲ ਅਤੇ ਮਨ ਨਾਲ ਬਣਾਉਂਦੀ ਹਾਂ ਅਤੇ ਮੇਰੇ ਘਰਦਿਆਂ ਨੂੰ ਮੇਰੇ ਹੱਥ ਦਾ ਖਾਣਾ ਬਹੁਤ ਹੀ ਵਧੀਆ ਲੱਗਦਾ ਹੈ ਜੋ ਕਈ ਮਸਾਲੇ ਹਨ ਜੋ ਇਸ ਦ ਦਾ ਸਵਾਦ ਨੂੰ ਵਿੱਚ ਵਾਧਾ ਕਰ ਦਿੰਦੇ ਹਨ ਅਤੇ ਬਹੁਤ ਹੀ ਵਧੀਆ ਬਣਾ ਦਿੰਦੇ ਹਨ